ਸਾਡਾ ਧਰਮ ਸਾਨੂੰ ਸਾਡੀ ਸਿਹਤ ਸੰਭਾਲ ਬਾਰੇ ਸਿੱਖਿਆ ਦਿੰਦਾ ਹੈ ਇਸ ਵਿੱਚ ਸਾਡਾ ਧਰਮ ਸਾਨੂੰ ਦੱਸਦਾ ਹੈ ਕਿ ਅਸੀਂ ਆਪਣੀ ਸਿਹਤ ਦੀ ਸਿਹਤ ਦੀ ਸੰਭਾਲ ਕਿਵੇਂ ਕਰਨੀ ਹੈ ਅਸੀਂ ਤੰਦਰੁਸਤ ਕਿਵੇਂ ਰਹਿਣਾ ਹੈ ਸਾਡੇ ਸਮਾਜ ਵਿੱਚ ਖੇਤੀਬਾੜੀ ਵਿੱਚ ਜੋ ਵੀ ਫਸਲਾਂ ਉਗਾਈਆਂ ਜਾਂਦੀਆਂ ਹਨ ਅਸੀਂ ਉਹਨਾਂ ਦੀ ਵਰਤੋਂ ਕਿਵੇਂ ਸਹੀ ਤਰੀਕੇ ਨਾਲ਼ ਕਰਨੀ ਹੈ ਜਿਸ ਕਰਕੇ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਇਸ ਵਿੱਚ ਜੋ ਅਸੀਂ ਕਣਕ ਪਿਸਾ ਕੇ ਖਾਂਦੇ ਹਾਂ ਅਤੇ ਚਾਵਲ ਖਾਂਦੇ ਹਾਂ ਬਾਜਰੇ ਦੀ ਰੋਟੀ ਇਹ ਸਾਰੀਆਂ ਹੀ ਸਾਡੀ ਸਿਹਤ ਨੂੰ ਠੀਕ ਰੱਖਦੀਆਂ ਹਨ ਸਾਡੇ ਧਰਮ ਵਿੱਚ ਸਭ ਤੋਂ ਜ਼ਰੂਰੀ ਇਹ ਵੀ ਹੈ ਕਿ ਅਸੀਂ ਸਰੀਰਕ ਤੌਰ 'ਤੇ ਵੀ ਠੀਕ ਠਾਕ ਹੋਈਏ ਅਤੇ ਮਾਨਸਿਕ ਤੌਰ 'ਤੇ ਵੀ ਠੀਕ ਹੋਈਏ ਸਰੀਰਕ ਤੌਰ 'ਤੇ ਅਸੀਂ ਖਾਣ ਪੀਣ ਦੀਆਂ ਵਸਤੂਆਂ ਨੂੰ ਸਹੀ ਸਮੇਂ 'ਤੇ ਵਰਤੋਂ ਦਾ ਸੇਵਨ ਕਰੀਏ ਇਸ ਦੇ ਨਾਲ਼ ਨਾਲ਼ ਅਸੀਂ ਮਾਨਸਿਕ ਤੌਰ 'ਤੇ ਆਪਣੇ ਮਨ ਨੂੰ ਸ਼ਾ ਸ਼ਾਂਤਮਈ ਤਰੀਕੇ ਨਾਲ਼ ਰੱਖੀਏ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਰੌਲਾ ਰੱਪਾ ਨਹੀਂ ਹੋਣਾ ਚਾਹੀਦਾ ਕੋਈ ਵੀ ਗੱਲ ਹੈ ਸਾਨੂੰ ਚੁੱਪ ਚਾਪ ਬੈਠ ਕੇ ਕਰ ਲੈਣੀ ਚਾਹੀਦੀ ਹੈ ਇਸ ਵਿੱਚ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਸਾਡਾ ਧਰਮ ਸਾਨੂੰ ਦੱਸਦਾ ਹੈ ਕਿ ਅਸੀਂ ਏਕਤਾ ਕਿਵੇਂ ਰੱਖਣੀ ਹੈ ਅਸੀਂ ਇਕੱਠੇ ਕਿਵੇਂ ਰਹਿਣਾ ਹੈ ਅਤੇ ਆਪਸ ਵਿੱਚ ਗੱਲਬਾਤ ਕਿਵੇਂ ਕਰਨੀ ਹੈ ਸਾਡੇ ਧਰਮ ਵਿੱਚ ਵੱਖ ਵੱਖ ਲੋਕ ਰਹਿੰਦੇ ਹਨ ਅਤੇ ਉਹਨਾਂ ਦੀ ਭਾਸ਼ਾਵਾਂ ਸਾਡੇ ਤੱਕ ਪਹੁੰਚਦੀਆਂ ਹਨ ਸਾਡੀ ਭਾਸ਼ਾਵਾਂ ਉਹਨਾਂ ਨੂੰ ਸੁਣਨ ਵਿੱਚ ਮਿਲਦੀਆਂ ਹਨ ਜਿਸ ਕਰਕੇ ਸਾਨੂੰ ਬਹੁਤ ਹੀ ਜਾਣਕਾਰੀ ਮਿਲਦੀ ਹੈ ਸਭ ਤੋਂ ਜ਼ਰੂਰੀ ਇਹ ਹੈ ਕਿ ਅਸੀਂ ਸਰੀਰਕ ਤੌਰ 'ਤੇ ਤੰਦਰੁਸਤ ਹੋਈਏ ਅਤੇ ਮਾਨਸਿਕ ਤੌਰ 'ਤੇ ਵੀ ਤੰਦਰੁਸਤ ਹੋਈਏ ਇਸ ਲਈ ਸਾਨੂੰ ਸਮੇਂ ਸਮੇਂ 'ਤੇ ਸਹੀ ਮਾਤਰਾ ਵਿੱਚ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਆਪਣੇ ਮਨ ਨੂੰ ਪੂਰੀ ਸ਼ਾਂਤੀ ਵਿੱਚ ਰੱਖਣਾ ਚਾਹੀਦਾ ਹੈ ਸਾਨੂੰ ਕੋਈ ਵੀ ਫੈਸਲਾ ਜਾਂ ਜਲਦਬਾਜ਼ੀ ਵਿੱਚ ਨਹੀਂ ਲੈਣਾ ਚਾਹੀਦਾ ਕੋਈ ਵੀ ਗੱਲ ਹੁੰਦੀ ਹੈ ਤਾਂ ਬੈਠ ਕੇ ਸ਼ਾਂਤੀ ਨਾਲ਼ ਕਰ ਲੈਣੀ ਚਾਹੀਦੀ ਹੈ ਇਸ ਤਰ੍ਹਾਂ ਸਾਡੇ ਧਰਮ ਵਿੱਚ ਇਹ ਜ਼ਰੂਰੀ ਸਾਡਾ ਧਰਮ ਇਹ ਦੱਸਦਾ ਹੈ ਕਿ ਅਸੀਂ ਆਪਣੀ ਸਿਹਤ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਚਾਹੀ ਕਰਨੀ ਹੈ ਇਸ ਵਿੱਚ ਸਾਨੂੰ ਬਹੁਤ ਹੀ ਸਿੱਖਣ ਨੂੰ ਮਿਲਦਾ ਹੈ ਇਸ ਵਿੱਚ ਇਹ ਵੀ ਜ਼ਰੂਰੀ ਹੈ ਕਿ ਸਾਨੂੰ ਸ਼ਾਂਤੀ ਕਾਇਮ ਰੱਖਣੀ ਚਾਹੀਦੀ ਹੈ ਅਸੀਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਠੀਕ ਠਾਕ ਹੋਣੇ ਚਾਹੀਦੇ ਹੈ ਸਾਡੇ ਧਰਮ ਵਿੱਚ ਸਾਨੂੰ ਇਹ ਵੀ ਅਨੁਭਵ ਕਰਵਾਇਆ ਗਿਆ ਹੈ ਕਿ ਏਕਤਾ ਕਾਇਮ ਰੱਖਣੀ ਚਾਹੀਦੀ ਹੈ ਹਰੇਕ ਹਰੇਕ ਇਨਸਾਨ ਨੂੰ ਪਿਆਰ ਨਾਲ਼ ਮਿਲਣਾ ਚਾਹੀਦਾ ਹੈ ਕਿਸੇ ਵੀ ਇਨਸਾਨ ਨਾਲ਼ ਕਿਸੇ ਵੀ ਤਰ੍ਹਾਂ ਦਾ ਭੇਦ ਭਾਵ ਨਹੀਂ ਕਰਨਾ ਚਾਹੀਦਾ ਕਿਉਂਕਿ ਹਰ ਇੱਕ ਇਨਸਾਨ ਬਰਾਬਰ ਹੁੰਦਾ ਹੈ ਇਸ ਵਿੱਚ ਕੋਈ ਵੀ ਵਿਤਕਰਾ ਭੇਦ ਭਾਵ ਨਹੀਂ ਹੁੰਦਾ ਹੈ ਇਸ ਤਰ੍ਹਾਂ ਸਾਨੂੰ ਕਿਸੇ ਵੀ ਗੱਲ ਨੂੰ ਸ ਸ਼ਾਂਤਮਈ ਤਰੀਕੇ ਨਾਲ਼ ਹੱਲ ਕਰਨਾ ਚਾਹੀਦਾ ਹੈ ਅਤੇ ਇਸ ਵਿੱਚ ਸਾਨੂੰ ਆਪਣੀ ਸਿਹਤ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਸਾਡਾ ਧਰਮ ਸਾਨੂੰ ਇਹਨਾਂ ਚੀਜ਼ਾਂ ਲਈ ਪ੍ਰੇਰਿਤ ਕਰਦਾ ਹੈ